ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਮੋਹਾਲੀ ਜ਼ਿਲ੍ਹੇ ਦੇ ਇਮਪਲੋਏਮੈਂਟ ਔਫਿਸ ਦੀ ਮਨੇਜਰ ਸਲੋਨੀ ਬੋਲ ਰਹੀ ਹਾਂ ਹਾਂਜੀ ਹਾਂਜੀ ਤੁਹਾਨੂੰ ਮੋਹਾਲੀ ਦੀਆਂ ਜੋਬਸ ਬਾਰੇ ਅਸੀਂ ਦੱਸ ਸਕਦੇ ਹਾਂ ਤੁਸੀਂ ਮੈਨੂੰ ਆਪਣਾ ਰਿਜ਼ਿਊਮ ਸੈਂਂਡ ਕਰਦੋ ਹੂੰ ਕੀ ਤੁਸੀਂ ਫਰੈਸ਼ਰ ਹੋ ਅੱਛਾ ਅੱਛਾ ਤੁਹਾਡੀ ਕੀ ਕੀ ਕੁਆਲੀਫਿਕੇਸ਼ਨਸ ਨੇ ਅੱਛਾ ਠੀਕ ਹੈ ਪੰਜ ਵੈਸੇ ਤਾਂ ਸਟਾਰਟਿੰਗ 'ਚ ਐਨੀ ਜ਼ਿਆਦਾ ਨਹੀਂ ਹੁੰਦੀ ਥੋੜੀ ਹੈ ਪੰਜ ਸੌ ਹੈ ਠੀਕ ਹੈ ਤੁਸੀਂ ਜ਼ਰੂਰ ਆਇਓ ਤੁਹਾਨੂੰ ਸਾਰੀਆਂ ਜੋਬਸ ਬਾਰੇ ਅਸੀਂ ਦੱਸਾਂਗੇ ਥੈਂਕ ਯੂ